ਜਦੋਂ ਮੈਂ ਖੇਤੀ ਦਾ ਕੰਮ ਸ਼ੁਰੂ ਕੀਤਾ ਸੀ ਮੈਂ ਕਣਕ ਜਿਵੇਂ ਕਣਕ ਬੀਜਦੇ ਹਨ ਮੱਕੀ ਛਿੱਟੇ ਦੇ ਨਾਲ ਬੀਜਦੇ ਹਨ ਮੈਂ ਜਦੋਂ ਜੀਰੀ ਦਾ ਕੰਮ ਸ਼ੁਰੂ ਕੀਤਾ ਤਾਂ ਮੈਂ ਉਵੇਂ ਜੀਰੀ ਦੇ ਬੀਜ ਦਾ ਛਿੱਟਾ ਲਗਾ ਦੀਆ ਅਤੇ ਮੇਰੇ ਪਿਤਾ ਜੀ ਮੈਨੂੰ ਆ ਕੇ ਮੇਰੀ ਗਲਤੀ ਕੱਢੀ ਉਹਨਾਂ ਨੇ ਕਿ ਏਦਾਂ ਨਹੀਂ ਬੀਜੀ ਦਾ ਅਤੇ ਇਸ ਤਰੀਕੇ ਦੇ ਨਾਲ ਬੀਜ ਬੀਜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੌ ਜੀਰੀ ਦੀ ਪੌਦ ਪੁੱਟ ਕੇ ਆਪਾਂ ਇਕੱਲਾ ਇਕੱਲਾ ਡੱਕਾ ਲਗਾਇਆ ਜਾਂਦਾ ਹਨ ਖੇਤ ਦੇ ਵਿੱਚ ਤਾਂ ਇਸ ਕਰਕੇ ਮੈਂ ਆਪਣੀ ਗਲਤੀ ਆਪਣੇ ਪਿਤਾ ਜੀ ਨੇ ਮੇਰੀ ਗਲਤੀ ਮੈਨੂੰ ਮੇਰੀ ਦੂਰ ਕੀਤੀ ਹੈ